ਸਤਿ ਸ਼੍ਰੀ ਅਕਾਲ ਜੀ ਮੈਂ ਨਾ ਜੀ ਸਵੇਰੇ ਟਰੈਵਲ ਏਜੰਸੀ ਤੋਂ ਕੈਬ ਬੁੱਕ ਕੀਤੀ ਸੀ ਮੈਂ ਦਿੱਲੀ ਜਾਣਾ ਸੀ ਅਤੇ ਛੇ ਵਜੇ ਮੈਨੂੰ ਕੈਬ ਉੱਥੇ ਘਰਾਂ ਚਾਹੀਦੀ ਸੀ ਪਰੰਤੂ ਨੌ ਵੱਜ ਚੁੱਕੇ ਆ ਤੁਹਾਡੀ ਕੈਬ ਹਲੇ ਤੱਕ ਮੇਰੇ ਤੱਕ ਪਹੁੰਚੀ ਨਹੀਂ ਹੈ ਅਤੇ ਨਾ ਮੈਨੂੰ ਤੁਹਾਡੀ ਕੋਈ ਇਨਫੋਰਮੇਸ਼ਨ ਆਈ ਹੈ ਉਸ ਪ੍ਰਤੀ ਅਤੇ ਹੁਣ ਤੁਸੀਂ ਦੂਜੀ ਕੈਬ ਭੇਜੋਂਗੇ ਜਾਂ ਮੈਨੂੰ ਕੋਈ ਹੋਰ ਕਿਸੇ ਨਾਲ਼ ਸੰਪਰਕ ਕਰਵਾਉਂਗੇ ਮੇਰੀ ਜ਼ਰੂਰੀ ਮੀਟਿੰਗ ਹੈ ਅਤੇ ਉਸ ਲਈ ਮੈਨੂੰ ਅੱਜ ਹੁਣ ਗਿਆਰ੍ਹਾਂ ਵਜੇ ਤੱਕ ਪਲੀਸ ਕੈਬ ਭੇਜੀ ਜਾਵੇ ਮੈਂ ਤੁਹਾਡਾ ਧੰਨਵਾਦ ਈ ਕਰਦਾਂ